ਬੇਰੁਜ਼ਗਾਰੀ ਕਾਰਨ ਕਈ ਨੌਜਵਾਨ ਲੁੱਟਾਂ ਖੋਹਾਂ ਕਰਨ ਲੱਗ ਜਾਂਦੇ ਹਨ ਚੋਰੀਆਂ ਕਰਨ ਲੱਗ ਜਾਂਦੇ ਹਨ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਸਰਕਾਰਾਂ ਨੂੰ ਵੱਧ ਤੋਂ ਵੱਧ ਫੰਡ ਇਨਵੈਸਟ ਕਰਨਾ ਚਾਹੀਦਾ ਹੈ ਜੋ ਕਿ ਨੌਜਵਾਨ ਅੱਗੇ ਪੜ੍ਹ ਸਕਣ ਸਕਿੱਲ 'ਚ ਡਿਵੈਲਮੈਂਟ ਕਰ ਸਕਣ ਅਤੇ ਸਰਕਾਰਾਂ ਨੂੰ ਸਕਿੱਲ ਵਿੱਚ ਪੈਸੇ ਇਨਵੈਸਟ ਕਰਨੇ ਚਾਹੀਦੇ ਹਨ ਜੋ ਕਿ ਨੋ ਬੇਰੁਜ਼ਗਾਰ ਨੌਜਵਾਨ ਹਨ ਉਹ ਸਕਿੱਲ ਸਿੱਖ ਸਕਣ ਕੋਰਸ ਕਰ ਸਕਣ ਅਤੇ ਆਪਣੇ ਲਈ ਰੁਜ਼ਗਾਰ ਦਾ ਸਾਧਨ ਬਣਾ ਸਕਣ